ਅੱਜ ਦੇ ਸਮੇਂ ਵਿੱਚ ਅਪਰਾਧ ਬਹੁਤ ਵੱਧ ਰਿਹਾ ਹੈ ਜਿਸ ਦਾ ਮੁੱਢਲਾ ਕਾਰਨ ਇਹ ਹੈ ਕਿ ਲੋਕ ਬੇਰੁਜ਼ਗਾਰ ਨੇ ਜਿਹਨਾਂ ਕੋਲ ਕੰਮ ਕਾਰ ਨਹੀਂ ਹੈ ਕੋਈ ਕਮਾਈ ਦਾ ਸਾਧਨ ਨਹੀਂ ਹੈ ਇਸ ਕਰਕੇ ਉਹ ਆਪਣੇ ਗੁਜ਼ਾਰੇ ਲਈ ਜਾਂ ਤਾਂ ਚੋਰੀਆਂ ਕਰਦੇ ਨੇ ਜਾਂ ਡਾਕੇ ਪਾਉਂਦੇ ਨੇ ਜਾਂ ਨਸ਼ਿਆਂ ਵੱਲ ਹੋ ਜਾਂਦੇ ਨੇ ਇਸ ਕਰਕੇ ਸਾਨੂੰ ਇਹ ਕਰਨਾ ਚਾਹੀਦਾ ਹੈ ਕਿ ਜਨਤਾ ਨੂੰ ਵਿਹਲੀ ਨਹੀਂ ਰਹਿਣ ਦੇਣਾ ਚਾਹੀਦਾ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਲਾਉਣਾ ਚਾਹੀਦਾ ਰੁਜ਼ਗਾਰ ਦੇ ਪੱਧਰ ਨੂੰ ਵਧਾਉਣਾ ਹੈ ਪੰਜਾਬ ਵਿੱਚ ਤਾਂ ਕਰਕੇ ਹੀ ਅਸੀਂ ਇਸ ਅਪਰਾਧਾਂ 'ਤੇ ਠੱਲ੍ਹ ਪਾ ਪਾ ਸਕਾਂਗੇ ਅਤੇ ਜਿੰਨਾਂ ਹੋ ਸਕੇ ਰੁਜ਼ਗਾਰ ਦੇ ਸਾਧਨ ਜਿੱਦਾਂ ਹੁਣ ਇੱਥੇ ਨਵੀਆਂ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਹੈ ਜਦ ਤੱਕ ਨੌਜਵਾਨ ਅਠਾਰ੍ਹਾਂ ਸਾਲ ਤੋਂ ਉੱਪਰ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਕੁਛ ਆਰਥਿਕ ਮਦਦ ਕਰਨੀ ਚਾਹੀਦੀ ਸਰਕਾਰ ਨੂੰ ਤਾਂ ਜੋ ਉਹਨਾਂ ਨੂੰ ਜਿੰਮ ਜਾਣ ਲਈ ਜਾਂ ਕਿਤੇ ਜਾ ਇੰਟਰਵਿਊ ਦੇਣ ਲਈ ਵੀ ਜਾਣਾ ਪਵੇ ਤਾਂ ਉਹਨਾਂ ਕੋਲ ਚਾਰ ਪੈਸੇ ਹੋਣ ਜਦ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਹੈ ਨਾ ਹੀ ਉਹ ਕਿਤੇ ਇੰਟਰਵਿਊ ਦਿੰਦੇ ਹੈ ਨਾ ਹੀ ਕਿਤੇ ਜਿੰਮ ਜਾਣ ਦੀ ਕੋਸ਼ਿਸ਼ ਕਰਦੇ ਹੈ ਉਹ ਫਿਰ ਵਿਹਲੇ ਹੋ ਕੇ ਉਹ ਨਸ਼ਿਆਂ ਵੱਲ ਨੂੰ ਭੱਜਦੇ ਹੈ ਸਭ ਤੋਂ ਪਹਿਲਾਂ ਤਾਂ ਸਾਨੂੰ ਨਸ਼ਿਆਂ ਨੂੰ ਰੋਕਣਾ ਚਾਹੀਦਾ ਹੈ ਤਾਂ ਹੀ ਅਪਰਾਧ ਰੁਕੇਗਾ ਪੰਜਾਬ ਵਿੱਚ ਔਰ ਇਸ ਵਿੱਚ ਪੰਜਾਬ ਸਰਕਾਰ ਬਹੁਤ ਹੀ ਯਤਨ ਕਰ ਰਹੀ ਹੈ ਉਹਨਾਂ ਨੇ ਕਈ ਨਸ਼ੂ ਨਸ਼ਾ ਛੁਡਾਓ ਕੇਂਦਰ ਵੀ ਖੋਲ੍ਹੇ ਨੇ ਕਈ ਜਿੰਮ ਵੀ ਖੋਲ੍ਹ ਰਹੀ ਹੈ ਪਿੰਡਾਂ ਵਿੱਚ ਤਾਂ ਜੋ ਜਿਹੜੀ ਆਉਣ ਵਾਲ਼ੀ ਪੀੜ੍ਹੀ ਹੈ ਉਹਨਾਂ ਵੱਲ ਉਤਸ਼ਾਹਿਤ ਹੋਵੇ ਅਤੇ ਵਤਨ ਦੀਆਂ ਖੇਡਾਂ ਇੱਦਾਂ ਦੇ ਕਈ ਪ੍ਰੋਗਰਾਮ ਸਰਕਾਰ ਚਲਾ ਰਹੀ ਹੈ ਜਿਸ ਕਰਕੇ ਅਸੀਂ ਉਹਨਾਂ ਦਾ ਮਾਈਂਡ ਡਾਵਰਟ ਕਰਕੇ ਉਹਨਾਂ ਦੇ ਦਿਮਾਗ ਨੂੰ ਦੂਜੇ ਪਾਸੇ ਲਾ ਕੇ ਨਸ਼ਿਆਂ ਤੋਂ ਛੁਡਾ ਕੇ ਅਪਰਾਧਾਂ ਤੋਂ ਛੁਡਾ ਕੇ ਇਸ ਅਪਰਾਧਿਕ ਪ੍ਰਣਾਲੀ ਨੂੰ ਰੋਕੀਏ ਉਹ ਤੋਂ ਠੱਲ੍ਹ ਪਾਈਏ ਅਤੇ ਮੈਂ ਆਸ ਕਰਦਾ ਹਾਂ ਕਿ ਇਸ ਯਤਨ ਨਾਲ਼ ਸਾਡੇ ਪੰਜਾਬ ਵਿੱਚ ਅਪਰਾਧ ਦਾ ਪੱਧਰ ਬਹੁਤ ਘੱਟ ਜਾਵੇਗਾ ਧੰਨਵਾਦ